ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਪਿੰਡ ਦੀ ਕਮੇਟੀ ਦੇ ਮੁੱਖ ਪ੍ਰਧਾਨ ਬੋਲ ਰਹੇ ਹੋ ਜੀ ਅੱਛਾ ਜੀ ਅਤੇ ਇਹਦੇ ਬਾਰੇ ਕੁਝ ਕੰਪਲੇਂਟ ਵਗੈਰਾ ਦੱਸਣੀ ਸੀ ਤੁਹਾਨੂੰ ਕੁਝ ਪਿੰਡ ਦੇ ਮੁੱਦੇ ਆ ਜਿਹੜੇ ਜ਼ਰੂਰੀ ਆ ਅਤੇ ਉਹਨਾਂ 'ਤੇ ਅਜੇ ਤੱਕ ਹੱਲ ਨਹੀਂ ਹੋ ਰਿਹਾ ਮੈਡਮ ਜਿਹੜੇ ਆਪਣੇ ਪਿੰਡ ਦੀਆਂ ਸੜਕਾਂ ਹੈਗੀਆਂ ਨਾਲੀਆਂ ਹੈਗੀਆਂ ਉਹਨਾਂ ਦਾ ਕੰਮ ਅਜੇ ਅਧੂਰਾ ਹੀ ਪਿਆ ਉਹ ਅਜੇ ਸ਼ੁਰੂ ਹੀ ਨਹੀਂ ਹੋਇਆ ਹਾਂਜੀ ਮੈਡਮ ਇਹ ਪਿੰਡ ਆਪਣਾ ਜੀ ਚੰਗ ਪਿੰਡ ਆਪਣਾ ਇਹ ਹੀ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਮੈਡਮ ਇਹ ਹੀ ਆ ਵੀ ਸਾਰੀਆਂ ਜਿਹੜੀਆਂ ਸ਼ੁਰੂ ਤੋਂ ਹੀ ਇਹ ਸੜਕਾਂ ਨਾਲੀਆਂ ਦੀ ਪ੍ਰੋਬਲਮ ਚੱਲ ਰਹੀ ਹੈ ਇਹ ਕਦੋਂ ਤੋਂ ਬਣਦੀਆਂ ਆ ਰਹੀਆਂ ਨੇ ਪਰ ਸਾਡੇ ਪਿੰਡ 'ਚ ਅਜੇ ਤੱਕ ਨਹੀਂ ਬਣ ਚੁੱਕੀਆਂ ਇਹਨਾਂ ਵਿੱਚ ਕਾਫ਼ੀ ਦਿੱਕਤ ਆ ਰਹੀ ਹੈ ਪਾਣੀ ਦੀ ਨਿਕਾਸੀ ਹੈ ਨਹੀਂ ਪਿੰਡ ਵਿੱਚ ਪਾਣੀ ਖੜ੍ਹ ਜਾਂਦਾ ਅਤੇ ਆਉਣ ਜਾਉਣ ਨੂੰ ਬੜੀ ਦਿੱਕਤ ਹੁੰਦੀ ਹੈ ਹਾਂਜੀ ਹਾਂਜੀ ਅਤੇ ਇੱਕ ਸੜਕਾਂ ਉੱਪਰ ਗੰਦ ਬਹੁਤ ਲੋਕ ਸੱਟਦੇ ਆ ਉਹਨਾਂ 'ਤੇ ਵੀ ਥੋੜ੍ਹਾ ਗੌਰ ਕਰਿਓ ਮੈਡਮ ਇਹਨਾਂ ਗੱਲਾਂ ਉੱਪਰ ਜ਼ਰੂਰੀ ਗੌਰ ਕਰਿਓ ਇਹਨਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਾਂਜੀ ਹਾਂਜੀ ਹਾਂਜੀ ਹੋਰ ਕਾਫ਼ੀ ਹੈਗੀਆਂ ਅਤੇ ਮੈਡਮ ਉਹ ਤਾਂ ਮੈਡਮ ਹੈ ਬਾਕੀ ਤੁਸੀਂ ਕੋਈ ਐਕਸ਼ਨ ਲਓ ਤਾਂ ਹੀ ਲੋਕ ਸੁਧਰਨਗੇ ਕਹਿਣ ਨਾਲ ਤਾਂ ਕੁਛ ਨਹੀਂ ਹੁੰਦਾ ਹਾਂਜੀ ਅੱਛਾ ਜੀ ਅਤੇ ਕਾਫ਼ੀ ਹੋਰ ਵੀ ਮੁੱਦੇ ਹੈਗੇ ਆ ਜਿਹੜੇ ਦੇਖਣ ਵਾਲੇ ਆ ਉਹਨਾਂ 'ਤੇ ਵੀ ਤੁਸੀਂ ਗੌਰ ਕਰਿਓ ਅਤੇ ਜਿਵੇਂ ਸਕੂਲ ਦਾ ਮਸਲਾ ਹੈਗਾ ਸਕੂਲ ਵਿੱਚ ਲੜਾਈਆਂ ਝਗੜੇ ਹੋ ਰਹੇ ਆ ਅੱਜ ਕੱਲ੍ਹ ਉਹਨਾਂ 'ਤੇ ਵੀ ਕੁਝ ਐਕਸ਼ਨ ਲਓ ਹਾਂਜੀ ਹਾਂਜੀ ਛੁੱਟੀ ਛੁੱਟੀ ਤੋਂ ਬਾਅਦ ਬੱਚੇ ਆਪਸ ਵਿੱਚ ਲੜ ਜਾਂਦੇ ਆ ਅਤੇ ਫਿਰ ਇੱਕ ਦੂਜੇ ਦਾ ਕਾਫ਼ੀ ਨੁਕਸਾਨ ਕਰਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਮੈਡਮ ਜ਼ਰੂਰ ਕਰਿਓ ਇਹਨਾਂ ਦਾ ਗੱਲਾਂ 'ਤੇ ਠੀਕ ਹੈ ਜੀ ਧੰਨਵਾਦ ਜੀ